ਮੈਨੂੰ ਜਾਨਵਰਾਂ ਦਾ ਬਹੁਤ ਸ਼ੌਕ ਹੈ ਮੇਰੇ ਕੋਲ ਦੋ ਜਰਮਨ ਸ਼ੈਫਰਡ ਹਨ ਜਿਨ੍ਹਾਂ ਦੀ ਦੇਖਭਾਲ ਮੈਂ ਵੀ ਕਰਦਾ ਹਾਂ ਅਤੇ ਜਦੋਂ ਮੈਂ ਕਈ ਵਾਰ ਕੰਮਕਾਰ ਲਈ ਬਾਹਰ ਜਾਂਦਾ ਹਾਂ ਤਾਂ ਮੇਰੇ ਪਰਿਵਾਰਕ ਮੈਂਬਰ ਉਹਨਾਂ ਦੀ ਸਾਂਭ ਸੰਭਾਲ ਕਰਦੇ ਹਨ ਇਹਨਾਂ ਦੇ ਲਈ ਮੈਂ ਘਰ ਵਿੱਚ ਵੱਖਰਾ ਕਮਰਾ ਪਾਇਆ ਹੋਇਆ ਹੈ ਅਤੇ ਸਵੇਰੇ ਸ਼ਾਮ ਇਹਨਾਂ ਨੂੰ ਮੈਂ ਘੁਮਾਉਂਦਾ ਹਾਂ ਇਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਇਹਨਾਂ ਦੇ ਆਲ਼ੇ ਦੁਆਲ਼ੇ ਦੀ ਸਫਾਈ ਦਾ ਬਹੁਤ ਧਿਆਨ ਰੱਖਦਾ ਹਾਂ ਅਤੇ ਸਮੇਂ ਸਮੇਂ 'ਤੇ ਡਾਕਟਰੀ ਇਲਾਜ ਵੀ ਕਰਵਾਉਂਦਾ ਰਹਿੰਦਾ ਹਾਂ